ਅੱਜ ਕੱਲ੍ਹ ਟੈਕਨੋਲਜੀ ਦੀ ਵਜ੍ਹਾ ਕਰਕੇ ਮੇਰੇ ਜੀਵਨ ਵਿੱਚ ਬਹੁਤ ਹੀ ਵੱਡੀਆਂ ਵੱਡੀਆਂ ਤਬਦੀਲੀਆਂ ਆਈਆਂ ਹਨ ਜਿਵੇਂ ਕਿ ਪਹਿਲਾਂ ਮੈਂ ਕੱਪੜੇ ਧੋਣ ਦੇ ਲਈ ਆਪਣੇ ਹੱਥਾਂ ਦੀ ਵਰਤੋਂ ਕਰਦਾ ਸੀ ਪਰ ਅੱਜ ਦੇ ਯੁੱਗ ਵਿੱਚ ਮੈਂ ਇਹ ਸਾਰਾ ਕੰਮ ਵਾਸ਼ਿੰਗ ਮਸ਼ੀਨ ਦੀ ਮਦਦ ਨਾਲ਼ ਬੜੇ ਹੀ ਆਸਾਨੀ ਅਤੇ ਘੱਟ ਸਮੇਂ ਵਿੱਚ ਕਰ ਲੈਂਦਾ ਹਾਂ ਜਿਸ ਨਾਲ਼ ਮੇਰੀ ਸਰੀਰਕ ਥਕਾਵਟ ਬਹੁਤ ਘੱਟ ਹੁੰਦੀ ਹੈ ਅਤੇ ਮੈਂ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ਼ ਗੱਲ ਕਰਨ ਦੇ ਲਈ ਚਿੱਠੀਆਂ ਜਾਂ ਆਦਿ ਟੈਕਨੋਲਜੀ ਦੀ ਵਰਤੋਂ ਕਰਦਾ ਸੀ ਪਰ ਅੱਜ ਦੇ ਟਾਈਮ ਵਿੱਚ ਮੋਬਾਇਲ ਫ਼ੋਨ ਦੀ ਮਦਦ ਨਾਲ਼ ਮੈਂ ਉਹਨਾਂ ਨਾਲ਼ ਆਸਾਨੀ ਨਾਲ਼ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ ਗੱਲ ਕਰ ਸਕਦਾ ਹਾਂ